ਨਮਸਕਾਰ ਮੇਰਾ ਨਾਮ ਮਾਨਿਕਬੀਰ ਸਿੰਘ ਹੈ ਮੈਂ ਤੁਹਾਡੀ ਕੰਪਨੀ ਐਮੇਜ਼ੋਨ ਡੋਟ ਕੌਮ ਤੋਂ ਇੱਕ ਟੂਰਿਸਟ ਬੈਗ ਮੰਗਵਾਇਆ ਹੈ ਜੋ ਕਿ ਬਹੁਤ ਹੀ ਵਧੀਆ ਆਇਆ ਹੈ ਮੈਂ ਤੁਹਾਡੇ ਨਾਲ ਇਸ ਪ੍ਰੋਡਕਟ ਬਾਰੇ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦਾ ਹਾਂ ਇਸ ਬੈਗ ਦੀ ਕੁਆਲਿਟੀ ਬਹੁਤ ਹੀ ਵਧੀਆ ਹੈ ਇਸ ਦੇ ਅੰਦਰਲਾ ਕੱਪੜਾ ਵੀ ਬਹੁਤ ਹੀ ਉੱਚੀ ਪ੍ਰਕਾਰ ਦਾ ਲੱਗਾ ਹੋਇਆ ਹੈ ਇਸ ਦਾ ਬਾਹਰੀ ਲੈਦਰ ਵੀ ਬਹੁਤ ਹੀ ਉੱਚੀ ਕੁਆਲਿਟੀ ਦਾ ਹੈ ਕਈ ਬੈਗ ਲੈਦਰ ਦੇ ਜਿਹੜੇ ਹੁੰਦੇ ਹਨ ਉਹਨਾਂ ਦਾ ਲੈਦਰ ਬਾਹਰੋਂ ਫਟ ਜਾਂਦਾ ਹੈ ਜਾਂ ਭੁਰ ਜਾਂਦਾ ਹੈ ਪਰ ਇਸ ਦਾ ਲੈਦਰ ਬਿਲਕੁਲ ਓਰਿਜ਼ਨਲ ਹੈ ਮੈਨੂੰ ਇਸ ਪ੍ਰੋਡਕਟ ਦੇ ਨਾਲ ਫਰੀ ਸ਼ਿਪਿੰਗ ਪ੍ਰਦਾਨ ਕੀਤੀ ਗਈ ਜਿਸ ਨਾਲ ਮੈਨੂੰ ਮਾਰਕਵਿਟ ਵਿੱਚ ਜਾ ਕੇ ਪੈਟਰੋਲ ਖ਼ਰਚ ਕੇ ਇਸ ਸਭ ਝੰਜਟ ਤੋਂ ਆਰਾਮ ਮਿਲਿਆ ਹੈ ਇਹ ਪ੍ਰੋਡਕਟ ਪੈਸੇ ਵੱਲੋਂ ਬਹੁਤ ਹੀ ਸਸਤਾ ਹੈ ਅਤੇ ਇਸ ਦੀ ਕੁਆਲਿਟੀ ਬਹੁਤ ਹੀ ਬਰਕਰਾਰ ਹੈ ਮੈਂ ਇਹ ਪ੍ਰੋਡਕਟ ਬਾਕੀ ਸਾਰਿਆਂ ਨੂੰ ਵੀ ਲੈਣ ਲਈ ਸਲਾਹ ਦੇਵਾਂਗਾ ਦੂਜਿਆਂ ਨੂੰ ਪ੍ਰੋਤਸਾਹਿਤ ਕਰਾਂਗਾ ਕੰਪਨੀ ਨੇ ਹੋਰ ਵੀ ਚੀਜ਼ਾਂ ਨਾਲ ਦਿੱਤੀਆਂ ਹਨ ਜਿਵੇਂ ਕਿ ਲੈਪਟੋਪ ਲਈ ਅਲੱਗ ਥਾਂ ਬਣਾਈ ਗਈ ਹੈ ਪਾਣੀ ਦੀ ਬੋਤਲ ਲਈ ਅਲੱਗ ਜਗ੍ਹਾ ਬਣਾਈ ਗਈ ਹੈ ਜਿਸ ਵਿੱਚ ਇਲਾਸਟਿਕ ਲਗਾ ਕੇ ਉਸ ਨੂੰ ਹਰ ਬੋਤਲ ਲਈ ਇੱਕ ਬਹੁਤ ਵਧੀਆ ਜਗ੍ਹਾ ਪ੍ਰਦਾਨ ਕੀਤੀ ਗਈ ਹੈ ਮੈਂ ਇਸ ਪ੍ਰੋਡਕਟ ਨੂੰ ਲੈ ਕੇ ਬਹੁਤ ਹੀ ਖੁਸ਼ ਹਾਂ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਪ੍ਰੋਡਕਟ ਨੂੰ ਖਰੀਦਣ ਦੀ ਸਲਾਹ ਦੇਵਾਂਗਾ ਧੰਨਵਾਦ